ਜੋ ਲੋਕ ਪਹਿਲੀ ਵਾਰ ਭੰਗੜਾ ਐਰੋਬਿਕਸ ਕਰਨ ਵਿੱਚ ਦਿਲਚਸਪੀ ਰੱਖਦੇ ਹਨ ਉਹਨਾਂ ਲਈ ਮੈਂ ਕਹਿਣਾ ਚਾਹਵਾਂਗੀ ਕਿ ਭੰਗੜਾ ਸਿੱਖਣਾ ਸਾਡੀ ਸਿਹਤ ਵਿੱਚ ਬਹੁਤ ਵਾਧਾ ਕਰਦਾ ਹੈ ਇਸ ਨਾਲ ਸਾਡੇ ਪੂਰੇ ਸਰੀਰ ਵਿੱਚ ਊਰਜਾ ਭਰਦੀ ਹੈ ਸਾਡੇ ਸਰੀਰ ਦੀਆਂ ਨਾੜੀਆਂ ਖੁੱਲ੍ਹਦੀਆਂ ਹਨ ਖੂਨ ਦੇ ਪਰਵਾਹ ਵਿੱਚ ਵਾਧਾ ਹੁੰਦਾ ਹੈ ਅੱਜ ਕੱਲ੍ਹ ਦੇ ਦੌਰ ਵਿੱਚ ਹਰ ਇਨਸਾਨ ਸਰੀਰਿਕ ਅਤੇ ਮਾਨਸਿਕ ਤਨਾਅ ਦਾ ਸ਼ਿਕਾਰ ਹੈ ਉਸ ਨੂੰ ਇੱਕ ਅਜਿਹੀ ਚੀਜ਼ ਦੀ ਤਲਾਸ਼ ਹੈ ਜੋ ਉਸਨੂੰ ਇਸ ਤਨਾਵ ਤੋਂ ਦੂਰ ਲੈ ਕੇ ਜਾ ਸਕੇ ਅਤੇ ਭੰਗੜਾ ਉਸ ਤਨਾਵ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ ਜਦੋਂ ਅਸੀਂ ਸੰਗੀਤ ਅਤੇ ਢੋਲ ਦੀ ਤਾਲ 'ਤੇ ਭੰਗੜਾ ਪਾਉਂਦੇ ਹਾਂ ਅਤੇ ਅਸੀਂ ਉਸ ਮਸਤੀ ਦੇ ਵਿੱਚ ਝੂਮਦੇ ਹੋਏ ਆਪਣੇ ਰੋਜ਼ਮਰਾ ਦੇ ਤਣਾਅ ਜ਼ਿੰਦਗੀ ਦੇ ਦੁੱਖ ਸਰੀਰਿਕ ਤਕਲੀਫਾਂ ਅਤੇ ਬਹੁਤ ਕੁਝ ਅਜਿਹੀਆਂ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਅ ਪਰੇਸ਼ਾਨ ਔਰ ਦੁਖੀ ਕਰਨ ਦਾ ਕੰਮ ਕਰਦੀਆਂ ਹਨ ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਰੋਜ਼ ਮਰਾ ਦੀ ਜਿੰਦਗੀ ਵਿੱਚ ਕੁਝ ਅਜਿਹਾ ਕਰੀਏ ਕੁਝ ਅਜਿਹਾ ਸੋਚੀਏ ਕੁਝ ਇਸ ਤਰ੍ਹਾਂ ਦੀ ਚੀਜ਼ ਵਿੱਚ ਆਪਣੇ ਆਪ ਨੂੰ ਲਗਾਈਏ ਜਿਸ ਨਾਲ ਸਾਡਾ ਤਨਾਅ ਦੂਰ ਹੋ ਸਕੇ